ਨਹੀਂ ਮੈਂ ਇਹ ਵਾਲੇ ਯੋਗ ਨਹੀਂ ਕੀਤੇ ਹਨ ਮੈਂ ਸਿਰਫ਼ ਸਾਧਾਰਨ ਯੋਗ ਹੀ ਕੀਤੇ ਹਨ ਜਿਵੇਂ ਕਿ ਸੂਰਜ ਨਮਸਕਾਰ ਆਸਨ ਤਾੜ ਆਸਨ ਵਜਰ ਆਸਨ ਅਨੁਲੋਮ ਵਿਲੋਮ ਅਤੇ ਹੋਰ ਕਈ ਪ੍ਰਾਣਾਯਾਮ ਆਦਿ ਯੋਗ ਸਾਡੇ ਸਰੀਰ ਨੂੰ ਸਵਸਥ ਰੱਖਦਾ ਹੈ ਅਤੇ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਇਸ ਨਾਲ ਸਾਡੇ ਸਰੀਰ ਦੀ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਯੋਗ ਕਰਨ ਨਾਲ ਸਾਡਾ ਸਰੀਰ ਚੁਸਤ ਅਤੇ ਦਰੁਸਤ ਰਹਿੰਦਾ ਹੈ ਅਤੇ ਸਾਨੂੰ ਰੋਜ਼ ਇਸ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਯੋਗ ਸਾਨੂੰ ਸਿਰਫ਼ ਇੱਕ ਐਕਸਪਰਟ ਤੋਂ ਹੀ ਸਿੱਖਣਾ ਚਾਹੀਦਾ ਹੈ